ਪੰਜ ਮਈ ਉੱਨੀ ਸੌ ਛਿਆਹਟ ਚੌਵੀ ਮਾਰਚ ਉੱਨੀ ਸੌ ਸਤਾਸੀ ਦਸ ਜੂਨ ਉੱਨੀ ਸੌ ਸਤਾਨਵੇਂ ਚੋਦਾਂ ਅਗਸਤ ਦੋ ਹਜ਼ਾਰ ਬਾਈ ਪੰਜ ਜਨਵਰੀ ਦੋ ਹਜ਼ਾਰ ਇੱਕੀ